ਹੈਲੋ

ਗੋਇਲ ਮੋਬਾਈਲ ਸਟੋਰ ਤੋਂ ਬੋਲਦੇ ਜੀ ਹਾਂਜੀ

ਹਾਂਜੀ

ਤੁਸੀਂ ਕਦੋਂ ਲਿਆ ਸੀ ਜੀ ਫੋਨ ਇਹ ਕਿੰਨਾ ਸਮਾਂ ਹੋ ਗਿਆ ਫੋਨ ਲਏ ਨੂੰ ਜੀ ਅੱਛਾ ਕੋਈ ਗੱਲ ਨਹੀਂ ਜੀ ਤੁਹਾਡੇ ਕੋਲ ਇਸ ਦਾ ਬਿੱਲ ਅਤੇ ਬੋਕਸ ਹੋਊਗਾ ਹਾਂਜੀ ਆਪਾਂ ਇਹਨੂੰ ਤੁਸੀਂ ਉਹਨੂੰ ਦੁਕਾਨ 'ਤੇ ਲੈ ਆਇਓ ਬਿੱਲ ਅਤੇ ਬੋਕਸ ਇਹਨਾਂ ਦੀ ਵਾਰੰਟੀ ਹੁੰਦੀ ਆ ਸਾਲ ਦੀ ਹਾਂਜੀ ਅਤੇ ਆਪਾਂ ਕੰਪਨੀ ਨੂੰ ਈਮੇਲ ਪਵਾ ਕੇ ਇਹਨਾਂ ਨੂੰ ਚੈੱਕ ਕਰਵਾ ਲਵਾਂਗੇ ਹਾਂਜੀ ਅਤੇ ਤੁਹਾਡਾ ਜਿਹੜਾ ਤੁਹਾਡੀ ਚਾਰਜ ਤਾਂ ਉਹ ਚਾਰਜ ਤਾਂ ਸਹੀ ਹੋਊਗਾ ਤੁਹਾਡਾ ਜੀ ਕੋਈ ਗੱਲ ਨਹੀਂ ਤੁਸੀਂ ਆਪਣੇ ਮੋਬਾਇਲ ਸਟੋਰ 'ਤੇ ਆ ਕੇ ਜੀ ਆਪਣਾ ਬਿੱਲ ਅਤੇ ਬੋਕਸ ਨਾਲ ਲਿਆਇਓ ਅਤੇ ਆਪਾਂ ਕੰਪਨੀ ਨੂੰ ਈਮੇਲ ਪਾ ਕੇ ਚੈੱਕ ਕਰ ਲਵਾਂਗੇ ਅਤੇ ਨਾਲੇ ਆਪਾਂ ਪਹਿਲਾਂ ਆਪਣੀ ਸ਼ੋਪ 'ਤੇ ਦੇਖ ਲਵਾਂਗੇ ਵੀ ਕੀ ਪ੍ਰੋਬਲਮ ਆ ਰਹੀ ਹੈਗੀ ਜੇ ਆਪਾਂ ਆਪਾਂ ਸਹੀ ਕਰ ਦੇਵਾਂਗੇ ਤਾਂ ਠੀਕ ਹੈ ਨਹੀਂ ਆਪਾਂ ਫੇਰ ਕੰਪਨੀਆਂ ਵੀ ਮੇਲ ਪਾ ਦੇਵਾਂਗੇ ਅਤੇ ਉਹ ਆਪਾਂ ਨੂੰ ਸਹੀ ਕਰਕੇ ਦੇ ਦੇਣਗੇ ਹਾਂ ਬੋਕਸ ਅਤੇ ਡੱਬਾ ਜ਼ਰੂਰ ਨਾਲ ਲੈ ਕੇ ਆਉਣਾ ਜੀ ਹਾਂ ਬਿੱਲ ਵੀ ਹਾਂਜੀ ਧੰਨਵਾਦ ਜੀ